ਹੈਲੋ ਸਰ ਮੈਂ ਅਮਨ ਟਰਾਂਸਪੋਰਟ ਏਜੰਸੀ ਨਾਲ ਗੱਲ ਕਰੀ ਰਹੀ ਹਾਂ ਅਤੇ ਐਕਚੂਅਲ 'ਚ ਮੈਂ ਪਰਸੋਂ ਚੰਡੀਗੜ੍ਹ ਟੂ ਫਤਿਹਗੜ੍ਹ ਸਾਹਿਬ ਟਰੈਵਲ ਕਰਨ ਦੇ ਲਈ ਤੁਹਾਡੀ ਟੈਕਸੀ ਬੁੱਕ ਕੀਤੀ ਸੀ ਜਿਸ 'ਚ ਮੈਨੂੰ ਕਾਫੀ ਸਾਰੀਆਂ ਪ੍ਰੋਬਲਮਸ ਆਈਆਂ ਅਤੇ ਪਹਿਲੀ ਪ੍ਰੋਬਲਮ ਇਹ ਸੀ ਕਿ ਮੈਨੂੰ ਤੁਹਾਡੇ ਡਰਾਈਵਰ ਦਾ ਬਿਹੇਵੀਅਰ ਨਹੀਂ ਵਧੀਆ ਲੱਗਿਆ ਕਸਟਮਰਸ ਦੇ ਨਾਲ ਡੀਲ ਕਰਨ ਦਾ ਉਹਦਾ ਤਰੀਕਾ ਨਹੀਂ ਸੀ ਵਧੀਆ ਬਹੁਤ ਜ਼ਿਆਦਾ ਰੂਡ ਬਿਹੇਵੀਅਰ ਸੀ ਅਤੇ ਡਰਾਈਵਿੰਗ ਓਵਰਟੇਕ ਬਹੁਤ ਜ਼ਿਆਦਾ ਕਰਦਾ ਸੀ ਅਤੇ ਦੂਜੀ ਟੈਕਸੀ ਦੇ ਰਿਲੇਟਿਡ ਜੋ ਮੈਂ ਗੱਲ ਕਹਿਣਾ ਚਾਹੁੰਦੀ ਹਾਂ ਕਿ ਜੋ ਟੈਕਸੀ ਦੇ ਵਿੱਚ ਸੀ ਇੱਕ ਤਾਂ ਉਸ 'ਚੋਂ ਸਮੈਲ ਆ ਰਹੀ ਸੀ ਪ੍ਰੋਪਰ ਉਹ ਵੋਸ਼ ਨਹੀਂ ਸੀ ਕੀਤੀ ਹੋਈ ਬਹੁਤ ਜ਼ਿਆਦਾ ਮਤਲਬ ਡਸਟ ਸੀਗੀ ਉਹਦੇ ਵਿੱਚ ਅਤੇ ਦੂਜਾ ਉਹਦੇ ਵਿੱਚੋਂ ਕਾਫੀ ਸਾਰੀਆਂ ਜਿਹੜੀਆਂ ਸੀਟਸ ਸੀਗੀਆਂ ਉਹ ਫਟੀਆਂ ਹੋਈਆਂ ਸੀਗੀਆਂ ਟੈਕਸੀ ਦੀਆਂ ਸੀਟਸ ਜਿਹੜੀਆਂ ਫਟੀਆਂ ਹੋਈਆਂ ਸੀ ਅਤੇ ਉਸ ਤੋਂ ਬਾਅਦ ਮੈਂ ਡਰਾਈਵਰ ਨੂੰ ਚੰਡੀਗੜ੍ਹ ਟੂ ਫਤਿਹਗੜ੍ਹ ਸਾਹਿਬ ਵੇ ਦੇ ਵਿੱਚ ਇੱਕ ਢਾਬੇ 'ਤੇ ਰੁਕਣ ਲਈ ਕਿਹਾ ਜਿਸ 'ਚ ਉਸਨੇ ਆਪਣੇ ਪ੍ਰੀ ਡਿਸਾਈਡਿਡ ਢਾਬੇ ਦੇ ਉੱਤੇ ਹੀ ਗੱਡੀ ਰੋਕੀ ਅਤੇ ਮੈਨੂੰ ਉਸ ਉੱਥੋਂ ਦਾ ਖਾਣਾ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਮੈਂ ਇਹ ਸਾਰੀਆਂ ਕੰਪਲੇਂਟਸ ਕਰਨਾ ਚਾਹੁੰਦੀ ਹਾਂ ਪਲੀਜ਼ ਤੁਸੀਂ ਇਹਦੇ ਗੌਰ ਕਰਿਓ